ਹੈਲੋ ਮੈਂ ਗੁਰਦੀਪ ਸਿੰਘ ਗੱਲ ਕਰ ਰਿਹਾ ਸੀਗਾ ਜੀ ਅਤੇ ਬਰਨਾਲਾ ਥਾਣੇ 'ਚੋਂ ਬੋਲਦੇ ਹੋ ਜੀ ਇੱਕ ਨਾ ਜੀ ਮੈਨੂੰ ਨਾ ਦੋ ਤਿੰਨ ਦਿਨ ਹੋ ਗਏ ਇੱਕ ਤਾਂ ਅਨਨੋਨ ਨੰਬਰ ਤੋਂ ਫੋਨ ਤੋਂ ਧਮਕੀਆਂ ਆਉਂਦੀਆਂ ਅਤੇ ਇੱਕ ਤਾਂ ਫਿਰੌਤੀ ਮੰਗਦੇ ਆ ਜੀ ਅਤੇ ਜਾਨੋਂ ਮਾਰਨ ਦੀਆਂ ਜੀ ਅਤੇ ਕਹਿੰਦੇ ਵੀ ਤੁਹਾਡੀ ਫੈਮਿਲੀ ਅਤੇ ਤੁਹਾਡੇ ਬੱਚਿਆਂ ਨੂੰ ਅਗਵਾਹ ਕਰ ਲਵਾਂਗੇ ਜੀ ਅਤੇ ਵਟਸਐਪ ਵਗੈਰਾ 'ਤੇ ਅਨਨੋਨ ਨੰਬਰ ਤੋਂ ਦੋ ਤਿੰਨ ਦਿਨ ਹੋ ਗਏ ਕਾਲ ਆਉਂਦੀ ਆ ਪਹਿਲਾਂ ਤਾਂ ਜੀ ਪਰ ਸੇਮ ਨੰਬਰ ਤੋਂ ਨਹੀਂ ਆਉਂਦੀ ਉਹ ਅਤੇ ਅਲੱਗ ਅਲੱਗ ਨੰਬਰਾਂ ਤੋਂ ਆਉਂਦੀ ਆ ਜੀ ਹਾਂਜੀ ਅਤੇ ਮੰਨ ਕੇ ਚੱਲੋ ਦੋ ਤਿੰਨ ਦਿਨ ਹੋ ਗਏ ਅਤੇ ਵਟਸਐਪ ਵਗੈਰਾ 'ਤੇ ਵੀ ਮੈਸੇਜ ਆਉਂਦੇ ਆ ਜੀ ਹੁਣ ਫੋਨ ਲਗਾਉਂਦਾ ਇੱਧਰੋਂ ਫੋਨ ਲੱਗਦਾ ਨਹੀਂ ਜੀ ਮੈਂ ਅਤੇ ਮੇਰੀ ਫੈਮਲੀ ਅਸੀਂ ਤਾਂ ਜੀ ਬਹੁਤ ਪਰੇਸ਼ਾਨ ਹਾਂ ਜੀ ਅਤੇ ਸਾਨੂੰ ਮੈਸੇਜ ਵਗੈਰਾ 'ਚ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਨਾ ਜੀ ਵੀ ਤੁਹਾਨੂੰ ਅਸੀਂ ਅਗਵਾਹ ਕਰਨ ਲਵਾਂਗੇ ਤੁਹਾਡੀ ਫੈਮਲੀ ਨੂੰ ਅਤੇ ਦਸ ਲੱਖ ਰੁਪਈਆ ਮੰਗਦੇ ਹੈ ਨਹੀਂ ਜੀ ਐਦਾਂ ਦਾ ਕੋਈ ਚੱਕਰ ਨਹੀਂ ਹੈਗਾ ਜੀ ਅਤੇ ਅਸੀਂ ਤਾਂ ਜੀ ਬਹੁਤ ਪਰੇਸ਼ਾਨ ਹੋ ਰਹੇ ਹਾਂ ਜੀ ਮੈਂ ਅਤੇ ਮੇਰੀ ਫੈਮਲੀ ਹੁਣ ਬੱਚਿਆਂ ਨੂੰ ਸਕੂਲ ਛੱਡਣਾ ਹੁੰਦਾ ਜੀ ਅਤੇ ਮਸਾਂ ਬਸ ਡਰਦੇ ਡਰਦੇ ਛੱਡ ਕੇ ਆਉਣਾ ਜੀ ਉਹ ਤਾਂ ਹੁਣ ਇਹ ਕਹਿੰਦੇ ਆ ਵੀ ਤੁਹਾਡਾ ਸਾਨੂੰ ਜੀ ਸਾਨੂੰ ਘਰੋਂ ਨਿਕਲਣ ਦਾ ਟਾਈਮ ਪਤਾ ਹੈ ਘਰੋਂ ਘਰੇ ਜਾਣ ਦਾ ਟਾਈਮ ਪਤਾ ਤੁਸੀਂ ਕਿੰਨੇ ਵਜੇ ਕਿੱਥੇ ਹੁੰਦੇ ਹੋ ਕੀ ਕਰਦੇ ਹੁੰਦੇ ਹੋ ਪੂਰੀ ਡਿਟੇਲ ਸਾਨੂੰ ਦੱਸ ਰਹੇ ਆ ਜੀ ਹੁਣ ਇਹ ਨਹੀਂ ਪਤਾ ਕੌਣ ਕੌਣ ਨਹੀਂ ਹੈਗਾ ਬਹੁਤ ਪਰੇਸ਼ਾਨ ਕਰ ਰੱਖਿਆ ਜੀ ਇਹਨਾਂ ਨੇ ਸ਼ੱਕ ਤਾਂ ਫਿਲਹਾਲ ਤਾਂ ਜੀ ਕਿਸੇ 'ਤੇ ਨਹੀਂ ਹੈਗਾ ਪਰ ਇੱਕ ਦੋ ਬੰਦੇ ਹੈਗੇ ਆ ਹੋ ਸਕਦਾ ਉਹਨਾਂ 'ਤੇ ਪੂਰਾ ਮੰਨ ਕੇ ਚੱਲੋ ਕਨਫਰਮ ਨਹੀਂ ਹੈਗਾ ਫਿਫਟੀ ਪਰਸੈਂਟ ਹੋ ਸਕਦੇ ਹੈ ਜੀ ਵੀ ਉਹ ਹੁੰਦੇ ਹੋਣ ਹਾਂਜੀ ਅਸੀਂ ਠੀਕ ਹੈ ਚਲੋ ਫੇਰ ਮੈਂ ਦੇਖਦਾ ਜੀ ਕੱਲ੍ਹ ਫਿਰ ਦਸ ਗਿਆਰ੍ਹਾਂ ਵਜੇ ਤਾਂ ਆਊਂ ਤੁਸੀਂ ਹੋਉਂਗੇ ਨਾ ਥਾਣੇ 'ਚ ਜੀ ਅਤੇ ਚਲੋ ਮੈਂ ਫਿਰ ਕੱਲ ਗਿਆਰ੍ਹਾਂ ਵਜੇ ਦੇਖਦਾ ਅਤੇ ਗਿਆਰ੍ਹਾਂ ਵਜੇ ਆ ਕੇ ਮੰਨ ਕੇ ਚੱਲੋ ਰਿਪੋਰਟ ਲਿਖਾਊਂਗਾ ਜੀ ਫੇਰ ਤੁਸੀਂ ਇਹਦੀ ਤਫਤੀਸ਼ ਜ਼ਰੂਰ ਕਰਿਓ ਜੀ ਉਹ ਨਾ ਹੋਵੇ ਜੀ ਨੁਕਸਾਨ ਹੋ ਜੇ ਕਿਉਂਕਿ ਜੀ ਮੇਰੀ ਫੈਮਿਲੀ ਬਹੁਤ ਡਰੀ ਹੋਈ ਆ ਜੀ ਹਾਂਜੀ ਠੀਕ ਆ ਜੀ ਹੁਣ ਮੈਂ ਤਾਂ ਜੀ ਬਾਹਰ ਗੇਟ 'ਤੇ ਕੈਮਰੇ ਵੀ ਲਗਾ ਕੇ ਲਵਾਤੇ ਸੀ ਉਹ ਵੀ ਚੈੱਕ ਕਰ ਰਹੇ ਹਾਂ ਪਰ ਕੋਈ ਬੰਦਾ ਐਦਾਂ ਦਾ ਅਨਨੋਨ ਪਰਸਨ ਦਿਖਿਆ ਨੀਗਾ ਜੀ ਹਾਂਜੀ ਠੀਕ ਹੈ ਹਾਂਜੀ ਉਹੀ ਸੀਗਾ ਜੀ ਅਤੇ ਇਸ ਲਈ ਸਾਨੂੰ ਹੱਲ ਕਰਕੇ ਦਿੱਤਾ ਜਾਵੇ ਜੀ ਅਤੇ ਬਾਕੀ ਕੱਲ ਮੈਂ ਆ ਜੂਗਾਂ ਹਾਂਜੀ ਰਿਪੋਰਟ ਲਿਖਵਾ ਜੂਗਾਂ ਜੀ ਆ ਕੇ ਹਾਂਜੀ ਠੀਕ ਹੈ ਜੀ